ਪੰਦਰਾਂ ਨਵੰਬਰ ਉੱਨੀ ਸੌ ਇਕਾਨਵੇਂ ਦੋ ਮਈ ਉੱਨੀ ਸੌ ਉਨਾਸੀ ਤਿੰਨ ਮਾਰਚ ਉੱਨੀ ਸੌ ਅੱਸੀ ਅਠਾਰਾਂ ਜੁਲਾਈ ਦੋ ਹਜ਼ਾਰ ਅੱਠ ਤਿੰਨ ਸਤੰਬਰ ਦੋ ਹਜ਼ਾਰ ਦੋ